ਹਾਂ ਜੇ ਪੰਜਾਬ 'ਚ ਹੀ ਸਿਲਸਿਲੇਵਾਰ ਜਾਂ ਆਪਾਂ ਗੱਲ ਕੀਤੀ ਜੇ ਗੱਲ ਕਰੀਏ ਰੀਜਨ ਦੇ ਹਿਸਾਬ ਨਾਲ ਜਿਵੇਂ ਤਿੰਨ ਹਿਸਿਆ 'ਚ ਵੰਡੀਏ ਮਾਝਾ ਮਾਲਵਾ ਅਤੇ ਦੁਆਬਾ ਅਤੇ ਜਿਹੜੀ ਖੇਤਰ ਜਿਹੜੀ ਦਰਿਆਵਾਂ ਦੇ ਕਰੀਬ ਨੇ ਜਿਹੜੀ ਨਦੀ ਨਾਲਿਆਂ ਦੇ ਕਰੀਬ ਨੇ ਜਿੱਥੇ ਪਾਣੀ ਦੀ ਜਿਹੜੀ ਉਪਲੱਬਧਤਾ ਹੈ ਉਹ ਜ਼ਿਆਦਾ ਨੇ ਅਤੇ ਧਰਤੀ ਤੋਂ ਜਿਹੜਾ ਪਾਣੀ ਦਾ ਲੈਵਲ ਹੈ ਜਿਹੜਾ ਗਰਾਊਂਡ ਵਾਟਰ ਲੈਵਲ ਹੈ ਉਹ ਜਿਹੜਾ ਉੱਚਾ ਅਤੇ ਪਾਣੀ ਦੇ ਜਿਹੜਾ ਆਪਾਂ ਟੀ ਡੀ ਐਸ ਬੋਲਦੇ ਹਾਂ ਟੋਟਲ ਡਿਜੋਲਵਲ ਸੋਲਵੈਂਟਸ ਜਿਹੜੇ ਹੁੰਦੇ ਜੇ ਉੱਥੇ ਕੰਮ ਹੈ ਮਤਲਬ ਜਿਹੜੀ ਪਾਣੀ ਦੀ ਸ਼ਾਰੀਅਤ ਹੈ ਸਧਾਰਨ ਭਾਸ਼ਾ 'ਚ ਹੀ ਗੱਲ ਕਰੀਏ ਤਾਂ ਜਿੱਥੇ ਪਾਣੀ ਕਮ ਖਾਰਾ ਉੱਥੇ ਪੰਜਾਬ 'ਚ ਲਗਭਗ ਜਿਹੜੀ ਹਰ ਫਸਲ ਕੀਤੀ ਜਾ ਸਕਦੀ ਹੈ ਜਿਵੇਂ ਚਾਵਲ ਗਰਮੀਆਂ 'ਚ ਜਿਹਨੂੰ ਆਪਾਂ ਜੀਰੀ ਬੋਲਦੇ ਹਾਂ ਅਤੇ ਕਣਕ ਸਰਦੀਆਂ ਦੇ ਮੌਸਮ ਮੱਕੀ ਅਤੇ ਕਪਾਹ ਅਤੇ ਤਿੰਨ ਫਸਲਾਂ ਲਿੱਤੀਆਂ ਜਾ ਸਕਦੀਆਂ ਅਤੇ ਆਲੂ ਵੀ ਬੀਜ਼ੇ ਜਾਂਦੇ ਆ ਗਾਜਰਾਂ ਅਤੇ ਸਬਜ਼ੀ ਸਬਜ਼ੀ ਦੀਆਂ ਵੀ ਮਤਲਬ ਵਰਤੀਆਂ ਜਾਂਦੀਆਂ ਸਭ ਸ ਤਰ੍ਹਾ ਦੀਆਂ ਸਬਜ਼ੀਆਂ ਬੀਜ਼ੀਆਂ ਜਾਂਦੀਆਂ ਅਤੇ ਪੋਲਟਰੀ ਫਾਰਮ ਦਾ ਵੀ ਪਿਛਲੇ ਕਈ ਸਾਲਾਂ 'ਚ ਵਿਕਾਸ ਹੋਇਆ ਜਿਵੇਂ ਮੁਰਗਾ ਪਾਲਣਾ ਹੈ ਅਤੇ ਅੰਡਾ ਅਤੇ ਉਹਦੇ 'ਚ ਪੋਲਟਰੀ ਉਦਯੋਗ ਹੈ ਜਿਵੇਂ ਮੀਟ ਉਦਯੋਗ ਉਹਦਾ ਵੀ ਵਿਕਾਸ ਹੋਣ ਲੱਗਿਆ ਅਤੇ ਬੱਕਰੀ ਪਾਲਣ ਵੀ ਨਜ਼ਰਾਂ 'ਚ ਕਿਉਂਕਿ ਐਗਰੀਕਲਚਰ ਯੂਨੀਵਰਸਿਟੀਆਂ ਦੀ ਸਾ ਸਾਂਝ ਕਰਕੇ ਉਹਨਾਂ ਦੀ ਵਿਗਿਆਨਿਕ ਉਹ ਗਿਆਨ ਸ਼ੇਅਰ ਕਰਨ ਕਰਕੇ ਨੌਲੇਜ ਕਰਕੇ ਅਤੇ ਪਸ਼ੂ ਧਨ 'ਚ ਗੱਲ ਕਰੀਏ ਤਾਂ ਮੱਝਾਂ ਦਾ ਸ਼ੁਰੂ 'ਚ ਪੰਜਾਬ 'ਚ ਰਹਿੰਦੀਆਂ ਰਹੀਆ ਅਤੇ ਪੰਜਾਬੀ ਲੋਕ ਕਿਉਂਕਿ ਪੰਜਾਬ ਦੇ ਲੋਕ ਧਰਤੀ ਨਾਲ ਜੁੜੇ ਆ ਖੇਤੀ ਕਰਦੇ ਪਏ ਆ ਤਾਂ ਉਹ ਮੱਝਾਂ ਗਾਵਾਂ ਰੱਖਣਾ ਉਹਨਾਂ ਦਾ ਸ਼ੁਰੂ ਤੋਂ ਇੱਕ ਸ਼ੌਂਕ ਰਿਹਾ ਅਤੇ ਜਿਹੜੀ ਛੋਟੀ ਪਿੰਡਾਂ 'ਚ ਜਿਹੜੇ ਛੋਟੇ ਛੋਟੇ ਪਿੰਡਾਂ ਉਹਨਾਂ 'ਚ ਵੀ ਕਈ ਲੋਕ ਰਹਿੰਦੇ ਆ ਜੇ ਉਹ ਭੇਡਾਂ ਅਤੇ ਬੱਕਰੀਆਂ ਵੀ ਪਾਲਦੇ ਆ ਹਜੇ ਵੀ ਉਹਨਾਂ ਦਾ ਪਰਿਵਾਰਿਕ ਕਿੱਤਾ ਹੈ ਜਿਨ੍ਹਾਂ ਨੂੰ ਮਾਲਕੀਤ ਕਿਹਾ ਜਾਂਦਾ ਵੀ ਭੇਡਾਂ ਅਤੇ ਬੱਕਰੀਆਂ ਅਤੇ ਜਿਹੜਾ ਸਮੂਹ ਉਹਨੂੰ ਮਾਲ ਕਿਹਾ ਜਾਂਦਾ ਅਤੇ ਜੇ ਆਪਾਂ ਜੇ ਜਿਹੜੇ ਹਿੱਸੇ ਚੋਂ ਮੈਂ ਆਉਂਦਾ ਸਪੈਸ਼ਲੀ ਜੇ ਮਾਲਵੇ ਦਾ ਜ਼ਿਕਰ ਕਰੀਏ ਤਾਂ ਮਾਲਵੇ 'ਚ ਪਾਣੀ ਦੀ ਕਮੀ ਕਰਕੇ ਅਤੇ ਧਰਤੀ ਚੋਂ ਮਤਲਬ ਜਿਹੜੀ ਪਾਣੀ ਦੀ ਸ਼ਾਰੀਅਤ ਹੈ ਖਾਰਾਪਣ ਵੱਧ ਹੋਣ ਕਰਕੇ ਉੱਥੇ ਕਈ ਵਾਰ ਲੋਕ ਨਰਮਾ ਜਿਹਨੂੰ ਆਪਾਂ ਕਪਾਹ ਬੋਲਦੇ ਆ ਉਹਦੀ ਵੀ ਫਸਲ ਕੱਢਣੀ ਪੈਂਦੀ ਕਿਉਂਕਿ ਚਾਵਲ ਜੀਰੀ ਹੈ ਜਿਹਦੇ ਵਾਸਤੇ ਪਾਣੀ ਦਾ ਘਾ ਪਾਣੀ ਦੀ ਘਾਟ ਹੈ ਅਤੇ ਸਰਕਾਰ ਵੀ ਇਹਨਾਂ ਸਾਲਾਂ 'ਚ ਕਿਉਂਕਿ ਧਰਤੀ ਆ ਪਾਣੀ ਹੇਠਾਂ ਜਾਣ ਲੱਗ ਗਿਆ ਤਾਂ ਕਰਕੇ ਉਹ ਇਨਸੈਂਟਿਵ ਦਿੰਦੀ ਹੈ ਛੋਟਾ ਦਿੰਦੀ ਹੈ ਨ ਕਪਾਹ ਦੀ ਖੇਤੀ 'ਤੇ